ਮੈਨੂੰ ਸਿਲਾਈ ਕਰਨਾ ਬਹੁਤ ਚੰਗਾ ਲੱਗਦਾ ਹੈ ਅਤੇ ਇਹ ਮੈਨੂੰ ਕਿਸੇ ਦੇ ਸਿਉਂਤੇ ਕੱਪੜੇ ਪਸੰਦ ਨਹੀਂ ਆਉਂਦੇ ਇਸ ਕਰਕੇ ਮੈਨੂੰ ਸਿਲਾਈ ਕਰਨਾ ਚੰਗਾ ਲੱਗਦਾ ਹੈ ਅਤੇ ਮੈਂ ਸਿਲਾਈ ਸੈਂਟਰ ਵਿੱਚੋਂ ਸਿੱਖੀ ਅਤੇ ਮੈਂ ਸਿਲਾਈ ਛੇ ਮਹੀਨੇ ਸੈਂਟਰ ਵਿੱਚ ਲਾ ਕੇ ਸਿੱਖੀ ਅਤੇ ਮੈਨੂੰ ਉਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਸਿਲਾਈ ਸਿਖਾਈ ਅਤੇ ਇੱਕ ਵਾਰ ਮੇਰੇ ਕੋਲੋਂ ਕਮੀਜ਼ ਖ਼ਰਾਬ ਹੋ ਗਿਆ ਅਤੇ ਮੈਂ ਕੱਪੜਾ ਆਪਣੇ ਕੋਲੋਂ ਲੈ ਕੇ ਉਹ ਦੂਰੀ ਦੋ ਦੀ ਸਿਲਾਈ ਕੀਤੀ ਅਤੇ ਉਹ ਬਹੁਤ ਵਧੀਆ ਤਰੀਕੇ ਨਾਲ ਬਣਿਆ ਅਤੇ ਜਦੋਂ ਮੈਂ ਕਟਾਈ ਕਰਨੀ ਹੁੰਦੀ ਹੈ ਮੇਰੇ ਕੋਲ ਕੋਈ ਬੋਲੇ ਨਾ ਕੋਈ ਰੌਲਾ ਨਾ ਪਵੇ ਅਤੇ ਇਸ ਕਰਕੇ ਮੇਰੇ ਤੋਂ ਕਟਾਈ ਬਹੁਤ ਵਧੀਆ ਚੰਗੇ ਤਰੀਕੇ ਨਾਲ ਹੁੰਦੀ ਹੈ ਅਤੇ ਮੇਰਾ ਧਿਆਨ ਵਧੀਆ ਆਪਣੀ ਕਟਾਈ ਵੱਲ ਰਹਿੰਦਾ ਹੈ ਅਤੇ ਮੈਨੂੰ ਇੱਕ ਸਿਲਾਈ ਕਰਨਾ ਬਹੁਤ ਚੰਗਾ ਲੱਗਦਾ ਹੈ ਬਹੁਤ ਵਧੀਆ ਲੱਗਦਾ ਹੈ ਅਤੇ ਮੈਨੂੰ ਕਿਸੇ ਦੇ ਕੱਪੜੇ ਸਿਉਂਤੇ ਪਸੰਦ ਨਹੀਂ ਆਉਂਦੇ ਇਸ ਕਰਕੇ ਮੈਂ ਆਪਣੇ ਕੱਪੜੇ ਆਪ ਸਿਉਂ ਕੇ ਪਾਉਣੇ ਮੈਨੂੰ ਚੰਗੇ ਲੱਗਦੇ ਆ ਣੇਤੇ ਕਈ ਵਾਰ ਮੈਨੂੰ ਕੋਈ ਕਟਾਈ ਕਰਦੇ ਸਮੇਂ ਕੋਈ ਚੀਜ਼ ਨਹੀਂ ਆਉਂਦੀ ਤਾਂ ਮੈਂ ਵੱਡਿਆਂ ਤੋਂ ਪੁੱਛਦੀ ਹਾਂ ਜਾਂ ਮੈਂ ਫੋਨ ਤੋਂ ਵੀਡੀਓ ਦੇਖ ਕੇ ਆਪਣੀ ਗਲਤੀ ਸੁਧਾਰਨ ਦੀ ਕੋਸ਼ਿਸ਼ ਕਰਦੀ ਹਾਂ ਅਤੇ ਮੈਨੂੰ ਕਟਾਈ ਕਰਦੇ ਸਮੇਂ ਬੋਲਣਾ ਚੰਗਾ ਨਹੀਂ ਲੱਗਦਾ ਅਤੇ ਨਾ ਹੀ ਵਧੀਆ ਤਰੀਕੇ ਨਾਲ ਕਟਾਈ ਹੁੰਦੀ ਹੈ ਇਸ ਕਰਕੇ ਮੈਨੂੰ ਚੁੱਪ ਕਰਕੇ ਕਟਾਈ ਕਰਨੀ ਚੰਗੀ ਲੱਗਦੀ ਹੈ ਅਤੇ ਬਹੁਤ ਧਿਆਨ ਨਾਲ ਕਟਾਈ ਕਰਨੀ ਚਾਹੀਦੀ ਹੈ ਅਤੇ ਪੂਰਾ ਪੂਰਾ ਧਿਆਨ ਮੇਰਾ ਕਟਾਈ ਵੱਲ ਹੋਣਾ ਇਹ ਇਹ ਹੀ ਮੇਰਾ ਅਨੁਭਵ ਹੈ